ਹਾਂ ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੇ ਪਤੀ ਵੀ ਬਾਗਬਾਨੀ ਵਿੱਚ ਕੰਮ ਕਰਦੇ ਹਨ ਅਸੀਂ ਬਹੁਤ ਸਾਰੇ ਪੌਦੇ ਲਗਾਏ ਹੋਏ ਹਨ ਫੇਰ ਉਹਦੇ ਵਿੱਚ ਅਸੀਂ ਮੌਸਮ ਦੇ ਹਿਸਾਬ 'ਤੇ ਪੌਦੇ ਲਗਾ ਲਗਾਉਂਦੇ ਹਨ ਅਤੇ ਜਿੱਦਾਂ ਫਲਾਂ ਦੇ ਪੇੜ ਹੁੰਦੇ ਹੈ ਨਿੰਬੂ ਫ ਸੇਬ ਅਨਾਰ ਅਮਰੂਦ ਆੜੂ ਚੀਕੂ ਆਦਿ ਹਨ ਅਤੇ ਉਸਦੀ ਦੇਖਭਾਲ ਲਈ ਅਸੀਂ ਬਹੁਤ ਸਾਰੇ ਸਾਵਨ ਸਾਧਨ ਵਰਤਦੇ ਹਨ ਛੋਟੇ ਛੋਟੇ ਪੌਦੇ ਵੀ ਉਗਾਉਂਦੇ ਹਨ ਉਸਨੂੰ ਸਮਿਆਂ ਸਿਰ ਪਾਣੀ ਡਾਲ ਪਾਣੀ ਪਾਉਣਾ ਅਤੇ ਔਰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰੇ ਪਤੀ ਔਫਿਸ ਜਾਂਦੇ ਹਨ ਅਤੇ ਉਸ ਤੋਂ ਬਾਅਦ ਮੈਂ ਉ ਉਸ ਵਿੱਚ ਆਪਣਾ ਸਮਾਂ ਨਿਕਾਲਦੀ ਹਾਂ ਅਤੇ ਉਹ ਫੇ ਵਾਪਿਸ ਆ ਕੇ ਫਿਰ ਸ਼ਾਮ ਨੂੰ ਬਾਗਬਾਨੀ ਵਿੱਚ ਹੀ ਚਲੇ ਜਾਂਦੇ ਹਨ ਉਹ ਉਹਦੇ ਵਿੱਚ ਸਵੇਰੇ ਤੋਂ ਉੱਠ ਕੇ ਲੱਗ ਜਾਂਦੇ ਹਨ ਜਿਵੇਂ ਵੀ ਕਿ ਕੋਈ ਸਬਜ਼ੀਆਂ ਵੀ ਉਗਾਉਂਦੇ ਹਨ ਅਤੇ ਉਸਨੂੰ ਵੀ ਬਹੁਤ ਸਹੀ ਤਰੀਕੇ ਨਾਲ ਤਿਆਰ ਕਰਨਾ ਪੈਂਦਾ ਹੈ ਬਾਗ਼ਬਾਨੀ ਵਿੱਚ ਬਹੁਤ ਹੀ ਸਾਰਾ ਸਮੇਂ ਨਿਕਾਲ ਕੇ ਕੰਮ ਕਰਨਾ ਪੈਂਦਾ ਹੈ ਅਤੇ ਉਸਨੂੰ ਸਮੇਂ ਸਮੇਂ ਪਰ ਕੋਲ ਉਸਨੂੰ ਸਮੇਂ ਸਮੇਂ ਪਰ ਹੀ ਲਗਾਉਣਾ ਹੁੰਦਾ ਹੈ ਅਤੇ ਛੋਟੇ ਪੌਦਿਆਂ ਨੂੰ ਸਮੇਂ ਸਮੇਂ ਪਰ ਬੱਚੇ ਦੀ ਤਰ੍ਹਾਂ ਹੀ ਪਾਲਣਾ ਪੈਂਦਾ ਹੈ ਅਤੇ ਪੋਸ਼ਣ ਦੇਣਾ ਪੈਂਦਾ ਹੈ